ਹਾਂਜੀ ਸਾਡੇ ਖੇਤਰ ਦੇ ਵਿੱਚ ਹੋਸਪਿਟਲ ਵੀ ਬਹੁਤ ਨੇ ਹੋਸਪਿਟਲਾਂ ਦੇ ਵਿੱਚ ਐਕਸਰੇ ਸੈਂਟਰ ਸੀ ਟੀ ਸਕੈਨ ਐਮ ਆਰ ਆਈ ਸਕੈਨ ਲਈ ਸਭ ਕੁਝ ਮੌਜੂਦ ਹੈਗਾ ਸਾਰੇ ਸਾਧਨ ਮੌਜੂਦ ਨੇ ਸਭ ਮਸ਼ੀਨਾਂ ਮੌਜੂਦ ਨੇ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਖੂਨ ਦੀ ਜਾਂਚ ਪਿਸ਼ਾਬ ਦੀ ਜਾਂਚ ਸੀ ਟੀ ਸਕੈਨ ਬਲੱਡ ਪ੍ਰੈਸ਼ਰ ਲਈ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਪੈਂਦੀ ਸਾਡੇ ਖੇਤਰ ਦੇ ਵਿੱਚ ਜਿਹੜੇ ਅਸੀਂ ਖੇਤਰ ਦੇ ਵਿੱਚ ਰਹਿੰਦੇ ਹਾਂ ਉਥੇ ਬਹੁਤ ਸਾਰੀਆਂ ਸਹੂਲਤਾਂ ਨੇ ਸਾਨੂੰ ਸਾਡੇ ਖੇਤਰ ਦੇ ਵਿੱਚ ਵੱਡੇ ਵੱਡੇ ਵਧੀਆ ਹੋਸਪਿਟਲ ਨੇ ਕੋਈ ਵੀ ਕਿਸੇ ਵੀ ਟ੍ਰੀਟਮੈਂਟ ਦੇ ਲਈ ਕਿਸੇ ਵੀ ਇਲਾਜ ਦੇ ਲਈ ਬਾਹਰ ਨਹੀਂ ਜਾਣਾ ਪੈਂਦਾ ਸਭ ਤਰ੍ਹਾਂ ਦੀਆਂ ਮਸ਼ੀਨਾਂ ਈਵਨ ਕਿ ਇਹੋ ਜਿਹੀਆਂ ਮਸ਼ੀਨਾਂ ਨੇ ਜਿਹਦੇ ਨਾਲ ਕਿ ਜਲਦੀ ਤੋਂ ਜਲਦੀ ਜਾਂਚ ਹੋ ਜਾਂਦੀ ਹੈ ਕੋਈ ਸਾਨੂੰ ਕਿਸੇ ਏ ਏਰੀਏ 'ਚੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ